ਹੈਲੋ ਸਰ ਸਰ ਮੈਂ ਅੰਜਲੀ ਬੋਲਦੀ ਹਾਂ ਪਟਿਆਲੇ ਤੋਂ ਸਰ ਮੈਂ ਤੁਹਾਡੇ ਸਵਿਗੀ ਐਪ ਤੋਂ ਖਾਣੇ ਦਾ ਔਡਰ ਕੀਤਾ ਸੀ ਕੁਛ ਟਾਈਮ ਪਹਿਲਾਂ ਹਾਂਜੀ ਸਰ ਮੇਰਾ ਔਡਰ ਹੈਗਾ ਸੀ ਸਰ ਮਟਰ ਪਨੀਰ ਅਤੇ ਨਾਨ ਦਾ ਸਰ ਜਦੋਂ ਮੈਂ ਆਪਣਾ ਔਡਰ ਕੀਤਾ ਸੀ ਉਹ ਤੋਂ ਸਿਰਫ਼ ਪੰਜ ਦਸ ਮਿੰਟ ਬਾਅਦ ਹੀ ਜਿਹੜਾ ਹੈਗਾ ਮੈਂ ਆਪਣਾ ਔਡਰ ਰੱਦ ਕਰ ਦਿੱਤਾ ਸੀ ਅਤੇ ਉਸ ਰੱਦ ਕੀਤੇ ਹੋਏ ਔਡਰ ਦੇ ਜਿਹੜੇ ਮੈਨੂੰ ਪੈਸੇ ਆ ਉਹ ਰਿਫੰਡ ਹੋਣੇ ਸੀ ਬਟ ਸਰ ਮੈਂ ਚਾਹੁੰਦੀ ਹਾਂ ਕਿ ਮੇਰੇ ਜਿਹੜੇ ਉਹ ਪੈਸੇ ਨੇ ਉਹ ਮੇਰੇ ਖਾਤੇ ਦੇ ਵਿੱਚ ਹੀ ਰਿਫੰਡ ਹੋ ਜਾਣ ਹਾਂਜੀ ਸਰ ਸਰ ਨਹੀਂ ਸਰ ਮੈਂ ਜੀ ਪੇਅ 'ਚ ਨਹੀਂ ਲੈਣਾ ਚਾਹੂੰਗੀ ਰਿਫੰਡ ਸਰ ਮੈਂ ਚਾਹੁੰਦੀ ਹਾਂ ਕਿ ਮੇਰੇ ਖਾਤੇ ਦੇ ਵਿੱਚ ਹੀ ਰਿਫੰਡ ਹੋ ਜਾਣ ਹਾਂਜੀ ਸਰ ਮੈਂ ਤੁਹਾਨੂੰ ਆਪਣਾ ਜਿਹੜਾ ਖਾਤਾ ਨੰਬਰ ਹੈ ਅਤੇ ਆਪਣਾ ਜਿਹੜਾ ਕੋਂਟੈਕਟ ਨੰਬਰ ਹੈ ਦੋਨੋਂ ਹੀ ਸਰ ਮੈਂ ਤੁਹਾਨੂੰ ਪ੍ਰੋਵਾਈਡ ਕਰ ਦੂੰਗੀ ਹਾਂਜੀ ਸਰ ਜ਼ਰੂਰ ਹੁਣੇ ਭੇਜ ਦਿੰਦੀ ਹਾਂ ਸਰ ਹਾਂਜੀ ਹਾਂਜੀ ਹਾਂਜੀ ਜੀ ਜੀ ਜੀ ਕਦੋਂ ਸਰ ਕਦੋਂ ਤੱਕ ਹੋ ਜਾਣਗੇ ਮੇਰੇ ਪੈਸੇ ਰਿਫੰਡ ਓਕੇ ਸਰ ਓਕੇ ਸਰ ਧੰਨਵਾਦ ਸਰ